ਆਪਾਂ ਆਪਣੇ ਸਕੂਲ ਅਤੇ ਕੋਲੇਜ ਟਾਈਮ ਦੇ ਵਿੱਚ ਬਹੁਤ ਸਾਰੇ ਸਾਇੰਸ ਪ੍ਰੋਜੈਕਟਾਂ ਦਾ ਹਿੱਸਾ ਹੁੰਦੇ ਹਾਂ ਮੈਂ ਵੀ ਆਪਣੇ ਸਕੂਲ ਅਤੇ ਕੋਲੇਜ ਟਾਈਮ ਦੇ ਵਿੱਚ ਬਹੁਤ ਸਾਰੇ ਸਾਇੰਸ ਪ੍ਰੋਜੈਕਟ ਦਾ ਹਿੱਸਾ ਰਹੀ ਜੇਕਰ ਮੈਂ ਗੱਲ ਕਰਾਂ ਆਪਣੇ ਪਹਿਲੇ ਸਾਇੰਸ ਪ੍ਰੋਜੈਕਟ ਦੀ ਸਕੂਲ ਦੇ ਵਿੱਚ ਤਾਂ ਮੈਂ ਸਭ ਤੋਂ ਪਹਿਲਾਂ ਮਨੁੱਖੀ ਦਿਲ ਬਣਾਇਆ ਸੀ ਮਨੁੱਖੀ ਦਿਲ ਦਾ ਮੋਡਲ ਬਣਾਇਆ ਸੀਗਾ ਕੀ ਇੱਕ ਹਾਰਟ ਬੰਦੇ ਦਾ ਕਿਵੇਂ ਕੰਮ ਕਰਦਾ ਤਾਂ ਉਹਦੇ ਵਿੱਚ ਮੈਂ ਇੱਕ ਟੀਮ ਦੇ ਵਿੱਚ ਕੰਮ ਕੀਤਾ ਸੀ ਤਾਂ ਉਸ ਟਾਈਮ ਮੈਨੂੰ ਆਪਣੀ ਸਟਰੈਂਥ ਵੀ ਪਤਾ ਲੱਗੀ ਕਿ ਮੈਂ ਇੱਕ ਟੀਮ ਦੇ ਵਿੱਚ ਕਿਵੇਂ ਜੂਝ ਸਕਦੀ ਹਾਂ ਮੈਂ ਇੱਕ ਟੀਮ ਇਕੱਠੇ ਬੰਦੇ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਟੀਮ ਵਰਕ ਕਿਵੇਂ ਹੁੰਦਾ ਹੈ ਤਾਂ ਉਹ ਉਸ ਪਰਜ ਉਸ ਪ੍ਰੋਜੈਕਟ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਕਿ ਆਪਾਂ ਇੱਕ ਹਿਊਮਨ ਬੀਂਗ ਦਾ ਹਾਰਟ ਕਿਸ ਤਰ੍ਹਾਂ ਵਰਕਿੰਗ ਕਰਦਾ ਹੈ ਉਹ ਸਾਰਾ ਵਰਕਿੰਗ ਦਿਖਾਇਆ ਸੀਗਾ ਜਿਵੇਂ ਕਿ ਆਪਾਂ ਇੱਕ ਜਾਰ ਹੁੰਦਾ ਹੈ ਕਿ ਉਹ ਕਿਵੇਂ ਪੰਪ ਕਰਦਾ ਹੈ ਹਿਊਮਨ ਹਾਰਟ ਤਾਂ ਆਪਾਂ ਬੈਲੂਨ ਯੂਜ ਕੀਤੇ ਸੀ ਅਤੇ ਆਪਾਂ ਪੰਪ ਕਰਨ ਦੇ ਲਈ ਹਾਰਟ ਨੂੰ ਪੰਪ ਕਰਨ ਦੇ ਵਾਸਤੇ ਆਪਣਾ ਬਲੱਡ ਸਰਕੂਲੇਸ਼ਨ ਹੋਣਾ ਜ਼ਰੂਰੀ ਹੈ ਸੋ ਬਲੱਡ ਸਰਕੂਲੇਸ਼ਨ ਦੇ ਲਈ ਆਪ ਸਟਰੋਅ ਯੂਜ ਕੀਤੇ ਸੀ ਤਾਂ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਵੇਸਟ ਚੀਜ਼ਾਂ ਯੂਜ ਕਰਕੇ ਆਪਣਾ ਸਕੂਲ ਦਾ ਪ੍ਰੋਜੈਕਟ ਬਣਾਇਆ ਸੀ ਸੋ ਮੈਂ ਉਸ ਟਾਈਮ ਬਹੁਤ ਜ਼ਿਆਦਾ ਖੁਸ਼ ਹੋਈ ਸੀ ਅਤੇ ਮੈਂ ਪਹਿਲੇ ਨੰਬਰ 'ਤੇ ਸਾਡਾ ਉਹ ਪ੍ਰੋਜੈਕਟ ਆਇਆ ਸੀ ਅਤੇ ਅਸੀਂ ਸਾਰੇ ਹੀ ਟੀਮ ਮੈਂਬਰ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਪ੍ਰੋਜੈਕਟ ਸੀ ਅਤੇ ਜੇਕਰ ਮੈਂ ਗੱਲ ਕਰਾਂ ਆਪਣੇ ਕਾਲਜ ਪ੍ਰੋਜੈਕਟ ਦੀ ਤਾਂ ਮੈਂ ਇੱਕ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੀ ਸਟੂਡੈਂਟ ਹੋਣ ਦੇ ਨਾਤੇ ਤਾਂ ਮੈਂ ਬਹੁਤ ਸਾਰੇ ਪ੍ਰੋਜੈਕਟ ਇਸ ਤਰ੍ਹਾਂ ਦੇ ਡੈਵਲਪ ਕੀਤੇ ਜਿਹਦੇ ਵਿੱਚ ਟੈਕਨੋਲੋਜੀ ਦਾ ਕੰਪਿਊਟਰ ਦਾ ਹਿੱਸਾ ਹੁੰਦਾ ਸੀ ਇੱਕ ਪਾਠ ਹੁੰਦਾ ਸੀ ਜਿਹਦੇ ਵਿੱਚ ਟੈਕਨੋਲੋਜੀ ਅਤੇ ਕੰਪਿਊਟਰ ਸੋ ਇਹ ਮੇਰੀ ਜ਼ਿੰਦਗੀ ਦੇ ਪ੍ਰੋਜੈਕਟ ਸੀਗੇ ਜਿਹੜੇ ਕਿ ਮੈਂ ਸਕੂਲ ਕਾਲਜਾਂ ਦੇ ਵਿੱਚ ਇਸ ਤਰ੍ਹਾਂ ਰਿਪ੍ਰਜੈਂਟ ਕੀਤੇ ਅਤੇ ਮੇਰਾ ਅਨੁਭਵ ਬਹੁਤ ਵਧੀਆ ਰਿਹਾ ਸੀ